ਮੇਰੀ ਇੱਕ ਫਰੈਂਡ ਦਾ ਵਿਆਹ ਸੀ ਪਰ ਉਹ ਵਿਆਹ 'ਚ ਬਹੁਤ ਥੋੜ੍ਹੇ ਦਿਨ ਸੀ ਅਤੇ ਪਰ ਮੈਂ ਆਪਣੇ ਮਤਲਬ ਸੂਟ ਨਹੀਂ ਸੀ ਖਰੀਦ ਸਕਦੀ ਪਰ ਮੈਂ ਫਿਰ ਔਨਲਾਈਨ ਫਲਿੱਪਕਾਰਟ 'ਤੇ ਕੱਪੜੇ ਦੇਖੇ ਤਾਂ ਮੈਨੂੰ ਇੱਕ ਸੂਟ ਬਹੁਤ ਪਸੰਦ ਆਇਆ ਅਤੇ ਮੈਂ ਜਦੋਂ ਸੂਟ ਔਡਰ ਕੀਤਾ ਤਾਂ ਜਦੋਂ ਮੇਰੇ ਕੋਲ ਪਹੁੰਚਿਆ ਤਾਂ ਉਹ ਬਹੁਤ ਵਧੀਆ ਨਿਕਲਿਆ ਮਤਲਬ ਉਹਦਾ ਫੈਬਰਿਕ ਉਹ ਕੱਪੜੇ ਦਾ ਡਿਜ਼ਾਇਨ ਉਹਦੀ ਕਢਾਈ ਉਹਦੀ ਸਟਿਚਿੰਗ ਉਹ ਬਹੁਤ ਵਧੀਆ ਸੀ ਅਤੇ ਜੇ ਮੈਂ ਬਜ਼ਾਰ ਤੋਂ ਮਤਲਬ ਕੋਈ ਸੂਟ ਖਰੀਦਣ ਜਾਂਦੀ ਤਾਂ ਮੇਰਾ ਇੱਕ ਤਾਂ ਟਾਈਮ ਲੱਗਦਾ ਫਿਰ ਉਹ ਸਟਿਚਿੰਗ ਕਰਵਾਉਂਦੇ ਅਤੇ ਇਸ ਲਈ ਮਤਲਬ ਜ਼ਿਆਦਾ ਫਿਰ ਵਰਕ ਕਰਵਾਉਣਾ ਪੈਂਦਾ ਉਹਦੇ ਲਈ ਜ਼ਿਆਦਾ ਟਾਈਮ ਲੱਗਦਾ ਪਰ ਜਿਵੇਂ ਫਲਿੱਪਕਾਰਟ ਤੋਂ ਮੰਗਵਾਇਆ ਉਹ ਬਹੁਤ ਹੀ ਸਸਤੇ ਰੇਟ ਵਿੱਚ ਮੈਨੂੰ ਪੈ ਗਿਆ ਉਹ ਸੂਟ ਮਤਲਬ ਵੀ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਉਹਦੇ ਨਾਲ ਫਿਰ ਮੈਂ ਉਸ ਤੋਂ ਬਾਅਦ ਤਿੰਨ ਚਾਰ ਸੂਟ ਹੋਰ ਮੰਗਵਾਏ ਜਿਨ੍ਹਾਂ ਦਾ ਵੀ ਕਦੇ ਮਤਲਬ ਕੋਈ ਰੰਗ ਨਹੀਂ ਫੇਟ ਹੋਇਆ ਅਤੇ ਉਹਨਾਂ ਦਾ ਰੰਗ ਬਹੁਤ ਵਧੀਆ ਨਿਕਲਿਆ ਉਹਦੀ ਕੁਆਲਿਟੀ ਬਹੁਤ ਵਧੀਆ ਸੀ ਅਤੇ ਕਿਤੋਂ ਵੀ ਫਟਿਆ ਨਹੀਂ ਸੀ ਜੋ ਉਹਦੀ ਕਢਾਈ ਸੀ ਅਤੇ ਇੱਕ ਚੁੰਨੀ ਦੀ ਲੈਂਥ ਅਤੇ ਉਹਦੀ ਫਿਟਿੰਗ ਵੀ ਬਹੁਤ ਵਧੀਆ ਆਈ ਕਿਉਂਕਿ ਉਹਦੇ ਵਿੱਚ ਇਹ ਦਿੱਤਾ ਹੁੰਦਾ ਕਿ ਤੁਹਾਨੂੰ ਕਿੰਨੀ ਲੈਂਥ ਚਾਹੀਦੀ ਆ ਕਿੰਨੀ ਫਿਟਿੰਗ ਚਾਹੀਦੀ ਆ ਕਿੱਦਾਂ ਦਾ ਰੰਗ ਚਾਹੀਦਾ ਕਿੱਦਾਂ ਦਾ ਕੱਪੜਾ ਚਾਹੀਦਾ ਉਸ ਹਿਸਾਬ ਨਾਲ ਮਤਲਬ ਸਾਡਾ ਓਰਡਰ ਸਾਨੂੰ ਦਿੰਦੇ ਨੇ ਅਤੇ ਸੋ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਉਸ ਤੋਂ ਬਾਅਦ ਮੈਂ ਬਹੁਤ ਸਾਰੇ ਹੋਰ ਵੀ ਸੂਟ ਨਵੇਂ ਲਏ ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਮੈਂ ਲਈਆਂ ਅਤੇ ਔਨਲਾਈਨ 'ਚ ਇਹੀ ਹੁੰਦਾ ਕਿ ਤੁਹਾਨੂੰ ਮਤਲਬ ਕਿਫਾਇਤੀ ਰੇਟ 'ਚ ਤੁਹਾਨੂੰ ਬਹੁਤ ਵਧੀਆ ਚੀਜ਼ ਮਿਲ ਜਾਂਦੀ ਹੈ